ਪਠਾਨਕੋਟ ਜ਼ਿਲ੍ਹੇ ਦੇ ਆਰਥਿਕ ਸਮਾਜਿਕ ਵਾਤਾਵਰਨ ਰਾਜਨੀਤਿਕ ਜ਼ਿਲ੍ਹੇ ਨੂੰ ਬੁਨਿਆਦੀ ਢਾਂਚੇ ਦੇ ਪੱਖੋਂ ਬਿਹਤਰ ਬਣਾਉਣ ਲਈ ਬਹੁਤ ਹੀ ਸਾਡੀ ਬਹੁਤ ਹੀ ਜ਼ਿਆਦਾ ਸਿਫਾਰਿਸ਼ ਹੈ ਜਿਵੇਂ ਕਿ ਕੁਛ ਚੀਜ਼ਾਂ ਕੁਝ ਚੀਜ਼ਾਂ ਇੱਦਾਂ ਦੀਆਂ ਹਨ ਜਿਹਨਾਂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਜਿੱਦਾਂ ਕਿ ਡਰਿੰਕਿੰਗ ਵਾਟਰ ਪੀਣ ਵਾਲਾ ਪਾਣੀ ਆ ਉਹ ਪਠਾਨਕੋਟ ਦੇ ਹਰ ਇਲਾਕਿਆਂ ਵਿੱਚ ਸਹੀ ਨਹੀਂ ਹੈ ਮਤਲਬ ਜਿੱਦਾਂ ਹਰ ਇੱਕ ਪਿੰਡ ਵਿੱਚ ਜਿਹੜਾ ਪਾਣੀ ਆ ਉਹ ਸਾਫ਼ ਨਹੀਂ ਹੈ ਜਿਹ ਜਿਹਦੇ ਕਰਕੇ ਲੋਕ ਬਿਮਾਰ ਪੈ ਰਹੇ ਹਨ ਲੋਕਾਂ ਦੀ ਬਿਮਾਰੀਆਂ ਬਹੁਤ ਹੀ ਜ਼ਿਆਦਾ ਵੱਧ ਰਹੀਆਂ ਹਨ ਪੀਣ ਵਾਲਾ ਪਾਣੀ ਗੰਦਾ ਹੋਏ ਤਾਂ ਬਿਮਾਰੀਆਂ ਬਹੁਤ ਹੀ ਵੱਧ ਜਾਂਦੀਆਂ ਹਨ ਇਸ ਕਰਕੇ ਸਾਨੂੰ ਉਸ ਉਹਦਾ ਸੁਧਾਰ ਕਰਨਾ ਚਾਹੀਦਾ ਹੈ ਅਨਇੰਮਪੋਲਾਏਮੈਂਟ ਬੇਰੁਜ਼ਗਾਰੀ ਬੇਰੁਜ਼ਗਾਰੀ ਬਹੁਤ ਹੀ ਜ਼ਿਆਦਾ ਵੱਧ ਗਈ ਹੈ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਪਈਆਂ ਜਿਸ ਕਰਕੇ ਉਹ ਆਪਣਾ ਦੇਸ਼ ਛੱਡ ਕੇ ਬਾਹਰ ਜਾਂਦੇ ਪਏ ਨੇ ਉਹਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ ਕੁਆਲਿਟੀ ਆਫ ਐਜੂਕੇਸ਼ਨ ਐਜੂਕੇਸ਼ਨ ਵੀ ਕੁਛ ਇੰਨੀ ਵਧੀਆ ਨਹੀਂ ਹੈ ਪਠਾਨਕੋਟ ਛੱਡ ਕੇ ਲੋਕ ਆ ਗੁਰਦਾਸਪੁਰ ਆਉਂਦੇ ਪਏ ਨੇ ਐਜੂਕੇਸ਼ਨ ਲੈਣ ਲਈ ਥੈਂਕ ਯੂ